ਸਤਿ ਸ਼੍ਰੀ ਅਕਾਲ ਜੀ ਹਾਂਜੀ ਹਾਂਜੀ

ਹਾਂਜੀ ਤੁਸੀਂ ਮਤਲਬ ਕਿਸ ਟਾਈਪ ਦੇ ਸੋਂਗ ਸੁਣਨਾ ਚਾਹੁੰਦੇ ਹੋ ਚਲੋ ਓਲਡ ਸਟਾਈਲ ਪੰਜਾਬੀ ਸਿੰਗਿਗ ਹਾਂਜੀ ਮਤਲਬ ਤੁਸੀਂ ਪਹਿਲਾਂ ਗਾ ਰਹੇ ਹੋ ਕਿਤੇ ਕਿ ਵੈਸੇ ਨਵਾਂ ਸਟਾਰਟ ਕਰਨਾ ਚਾਹੁੰਦੇ ਹੋ ਹਾਂਜੀ ਮਤਲਬ ਤੁਹਾਨੂੰ ਨੌਲੇਜ ਹੈ ਕੋਈ ਇੰਸਟਰੂਮੈਂਟ ਦੀ ਮਤਲਬ ਨਹੀਂ ਹੈਗੀ ਹਾਂ ਇਸਦਾ ਬੇਸਿਕਸ ਸਟੈਪ ਪਹਿਲਾਂ ਇਹ ਤੁਹਾਨੂੰ ਵੀ ਨੌਲੇਜ ਲੈਣੀ ਲੈਣੀ ਪੈਣੀ ਆ ਹਰਮੋਨੀਅਮ ਦੀ ਬੇਸਿਕ ਸਟੈਪ ਇਹੀ ਹੈ ਵੀ ਸਭ ਤੋਂ ਪਹਿਲਾਂ ਤੁਸੀਂ ਹਾਰਮੋਨੀਅਮ ਵਜਾਉਣਾ ਸਿੱਖਣਾ ਤੁਸੀਂ ਕੋਈ ਕੰਪਨੀ ਵਧੀਆ ਜਾਣਦੇ ਹੋ ਤੁਹਾਡੇ ਨੇੜੇ ਤੇੜੇ ਕੋਈ ਹੋਵੇ ਜੋ ਹਰਮੋਨੀਅਮ ਦਿੰਦੇ ਹੋਣ ਜਿੱਥੇ ਤੁਸੀਂ ਖਰੀਦ ਸਕੋ ਅਤੇ ਤੁਸੀਂ ਮਤਲਬ ਰਹਿੰਦੇ ਕਿੱਥੇ ਹੋ ਤੁਸੀਂ ਲੁਧਿਆਣੇ ਕਿਹੜੇ ਏਰੀਏ ਨੂੰ ਬਿਲੋਂਗ ਕਰਦੇ ਲੁਧਿਆਣੇ 'ਚ ਮੈਂ ਸ਼ਿਮਲਾਪੁਰੀ ਮਤਲਬ ਤੁਹਾਡੇ ਦੁੱਗਰੀ ਨੇੜੇ ਹੀ ਆ ਨਾ ਜੀ ਕੋਈ ਜ਼ਿਆਦਾ ਜ਼ਿਆਦਾ ਫਾਸਲਾ ਨਹੀਂ ਹੈਗਾ ਜੀ ਹਾਂਜੀ ਉੱਥੇ ਆਪਣੇ ਦੁਗਰੀ ਫੇਸ ਵਨ ਦੇ ਵਿੱਚ ਆਪਣੇ ਇੱਕ ਹੈਗੇ ਨੇ ਯਮੁਨਾ ਵਾਲੇ ਉਹਨਾਂ ਕੋਲੋਂ ਤੁਸੀਂ ਹਾਰਮੋਨੀਅਮ ਲੈ ਸਕਦੇ ਹੋ ਮਤਲਬ ਤੁਸੀਂ ਕਿਸ ਕ ਰੇਂਜ ਦੇ ਵਿੱਚ ਹਰਮੋਨੀਅਮ ਲੈਣਾ ਚਾਹੁੰਦੇ ਓ ਮਤਲਬ ਬਜਟ ਕਿੰਨਾ ਕੁ ਹੈ ਤੁਹਾਡਾ ਮਤਲਬ ਤੁਹਾਨੂੰ ਫਾਈਵ ਥਾਊਂਡੈਂਡ ਦੇ ਵਿੱਚ ਵਿੱਚ ਵਧੀਆ ਹਾਰਮੋਨੀਅਮ ਮਿਲ ਜਾਊਗਾ ਹਾਂਜੀ ਮਤਲਬ ਸੈਵਨ ਟੂ ਏਟ ਥਾਊਜੈਂਟ ਦੇ ਵਿੱਚ ਤੁਹਾਨੂੰ ਵਧੀਆ ਮਿਲ ਜਾਵੇਗਾ ਫਿਰ ਜੇ ਤੁਸੀਂ ਅਫੋਡ ਕਰ ਸਕਦੇ ਹੋ ਫਿਰ ਆਪਾਂ ਗਾਂਹ ਅੱਗੇ ਚੱਲੀਏ ਹਾਂਜੀ ਤੁਸੀਂ ਜਿਵੇਂ ਕਿ ਤੁਸੀਂ ਕਿਹਾ ਵੀ ਤੁਸੀਂ ਪੁਰਾਣਾ ਓਲਡ ਸਿੰਗਿੰਗ ਟਾਈਪ ਓਲਡ ਪੰਜਾਬੀ ਸੌਂਗ ਟਾਈਪ ਸਿੱਖਣਾ ਚਾਹੁੰਦੇ ਹੋ ਕੋਈ ਸਿੰਗਰ ਓਲਡ ਜਿੰਨਾ ਵਾਂਗੂੰ ਸਿੱਖਣਾ ਚਾਹੁੰਦੇ ਹੋ ਉਹਨਾਂ ਦਾ ਨਾਮ ਦੱਸ ਸਕਦੇ ਹੋ ਓਕੇ ਠੀਕ ਹੈ ਜੀ ਉਹਨਾਂ ਦੇ ਨਾ ਜੀ ਸੋਫਟ ਟੋਲ ਸੀਗੀ ਉਹ ਅਗਰੈਸਿਵ ਨਹੀਂ ਗਾਉਂਦੇ ਸੀਗੇ ਜਿਹੜੇ ਪੁਰਾਣਾ ਸਟਾਈਲ ਹੁੰਦਾ ਨਾ ਸੋਫਟ ਟੋਨ ਹੁੰਦੀ ਆ ਉਹਨਾਂ ਦੀ ਜੇ ਤੁਸੀਂ ਉਸੇ ਵਿੱਚ ਸਿੱਖਣਾ ਚਾਹੁੰਦੇ ਹੋ ਫਿਰ ਤੁਹਾਨੂੰ ਬੇਸਿਕ ਸਟੈੱਪ ਇਹੀ ਆ ਕਿ ਹਰਮੋਨੀਅਮ ਤੋਂ ਪਹਿਲਾਂ ਸਰਗਮ ਹੁੰਦੀਆਂ ਨੇ ਉਹ ਸਿੱਖਣੀਆਂ ਪੈਂਦੀਆਂ ਨੇ ਹਮ ਹਮ ਦੇਖੋ ਜੀ ਟਾਈਮ ਤਾਂ ਬਹੁਤ ਲੱਗ ਜਾਂਦਾ ਹੁੰਦਾ ਤੁਹਾਨੂੰ ਰੈਗੁਲਰ ਪ੍ਰੈਕਟਿਸ ਕਰਨੀ ਪੈਣੀ ਆ ਤਾਂ ਕੁਛ ਹੋ ਸਕਦਾ ਤੁਹਾਨੂੰ ਵੈਸੇ ਇੱਕ ਘੰਟਾ ਦਿਨ ਵਿੱਚ ਸਫੀਸ਼ੀਐਂਟ ਹੁੰਦਾ ਸਰਗਮ ਤਾਂ ਬੇਸਿਕਸ ਸਟੈਪ ਹੁੰਦਾ ਸਾ ਸਾ ਲਗਾਉਂਦੇ ਸਭ ਤੋਂ ਪਹਿਲਾਂ ਉਹਦੇ ਨਾਲ ਬੰਦੇ ਦੀ ਆਵਾਜ਼ ਗਲਾ ਸੈਟ ਕਰਦਾ ਅਤੇ ਜੇਕਰ ਤੁਸੀਂ ਸਵੇਰੇ ਤੜਕੇ ਤੜਕ ਸਾਰ ਉੱਠ ਕੇ ਸਾਹ ਲਾਇਆ ਕਰੋਗੇ ਇੱਕ ਘੰਟੇ ਲਈ ਫਿਰ ਤੁਹਾਡੀ ਆਵਾਜ਼ 'ਚ ਬਹੁਤ ਫਰਕ ਪੈ ਸਕਦਾ ਹਮ ਮਤਲਬ ਮਤਲਬ ਵੀ ਤੁਸੀਂ ਸਾਹ ਦੀ ਪ੍ਰੈਕਟਿਸ ਜਿੰਨੀ ਜ਼ਿਆਦਾ ਕਰੋਗੇ ਉਨੀ ਤੁਹਾਡੇ ਆਵਾਜ਼ ਦੇ ਵਿੱਚ ਮਿਠਾਸ ਆਵੇਗੀ ਉਨੀ ਜ਼ਿਆਦਾ ਮਿਠਾਸ ਜਿੰਨੀ ਮਿਠਾਸ ਆ ਸਕਦੀ ਉਨਾ ਤੁਸੀਂ ਪੁਰਾਣੇ ਸਟਾਇਲ ਦੇ ਵਿੱਚ ਗਾ ਸਕਦੇ ਉਨੀ ਕਿਉਂਕਿ ਉਹਨਾਂ ਦੀ ਸੋਫਟ ਟੋਨ ਸੀ ਹਾਂਜੀ ਮਤਲਬ ਮਤਲਬ ਇਹਦਾ ਕੋਈ ਪ੍ਰੋਪਰ ਐਸਟੀਮੇਟ ਦਾ ਨਾਂ ਲਈਏ ਕਿਉਂਕਿ ਹਰ ਇੱਕ ਤਾਂ ਗਲੇ ਦੇ ਅਲੱਗ ਹਿਸਾਬ ਹੁੰਦਾ ਵਾ ਕਿਸੇ ਨੂੰ ਕੋਈ ਟਾਈਮ ਵੱਧ ਲੱਗ ਜਾਂਦੇ ਕਿਸੇ ਨੂੰ ਟਾਈਮ ਘੱਟ ਲੱਗ ਜਾਂਦਾ ਮਤਲਬ ਤੁਸੀਂ ਮੰਨ ਕੇ ਚੱਲੋ ਵੀ ਇੱਕ ਸਾਲ ਦੇ ਵਿੱਚ ਵਿੱਚ ਤੁਹਾਡੇ ਆਵਾਜ਼ 'ਤੇ ਬਹੁਤ ਫਰਕ ਪੈ ਜੂਗਾ ਕੀ ਤੁਸੀਂ ਵਧੀਆ ਗਾਉਣ ਲੱਗ ਜੋਂਗੇ ਜਿਵੇਂ ਜਿਵੇਂ ਤੁਸੀਂ ਡੇ ਬਾਏ ਡੇ ਕਰਦੇ ਕਹਿ ਲਓ ਵੀ ਪ੍ਰੈਕਟਿਸ ਟਾਈਮ ਵਧਾ ਲੋਗੇ ਉੱਨਾ ਜ਼ਿਆਦਾ ਤੁਸੀਂ ਛੇਤੀ ਆਪਦਾ ਸਿੱਖ ਸਕਦੇ ਆ

ਅਗਲੇ ਮਤਲਬ ਬੇਸਿਕ ਹਾਰਮੋਨੀਅਮ ਹੀ ਆ ਇਹਦੇ ਨਾਲ ਤਾਂ ਬੰਦੇ ਦੀ ਆਵਾਜ਼ ਕਾਫੀ ਸੈਟ ਹੋ ਜਾਂਦੀ ਉਤੋਂ ਬਾਅਦ ਤੁਹਾਨੂੰ ਹੋਰ ਬਸ ਇੰਸਟਰੂਮੈਂਟ ਹੁੰਦੀ ਇੱਕ ਮੋਰ ਇੰਸਟਰੂਮੈਂਟ ਹੁੰਦਾ ਸਿਤਾਰ ਓਹ ਥੋੜ੍ਹਾ ਓਲਡ ਸਟਾਇਲ ਫਿਰ ਉਹਨਾਂ ਦਾ ਬਹੁਤ ਬੰਦੇ ਦੀ ਆਵਾਜ਼ 'ਚ ਫਰਕ ਪੈਂਦਾ ਹਮ ਹਾਂਜੀ ਹਾਂਜੀ ਹਾਂ ਹਾਂਜੀ ਈਮੇਲ ਆਈਡੀ 'ਤੇ ਆਈਡੀ ਤਾਂ ਮਿਲ ਜੂਗੀ ਮਤਲਬ ਤੁਸੀਂ ਪਹਿਲਾਂ ਗਾਇਆ ਨਹੀਂ ਨਾ ਨਾ ਕਦੇ ਮਤਲਬ ਤੁਸੀਂ ਆਫਲਾਈਨ ਜੇ ਚਾਹਵਾਨ ਹੋ ਤਾਂ ਆਫਲਾਈਨ ਵੀ ਤੁਹਾਨੂੰ ਪ੍ਰੈਕਟਿਸ ਕਰਵਾ ਸਕਦੇ ਹਾਂ ਹਾਂਜੀ ਮਤਲਬ ਤੁਹਾਨੂੰ ਗਿੱਲ ਚੌਕ ਆਉਣਾ ਪੈਣਾ ਜੀ ਗਿੱਲ ਚੌਂਕ ਆਪਣਾ ਗਿੱਲ ਚੌਂਕ ਪੁਲ ਦੇ ਨਾਲ ਗਲੀ ਨੰਬਰ ਸੱਤ

ਉੱਥੇ ਬਸ ਨੇੜੇ ਹੀ ਆ ਥੋੜ੍ਹਾ ਗਾਂਹ ਜਾ ਕੇ ਅੱਗੇ ਹੀ ਆ ਜੀ ਉੱਥੇ ਕੁ ਤੁਹਾਨੂੰ ਆਉਣਾ ਪੈਣਾ ਮਤਲਬ ਤੁਸੀਂ ਆਫਲਾਈਨ ਚਾਹਵਾਨ ਹੈਗੇ ਹੋ ਕਿ ਔਨਲਾਈਨ ਵੀ ਸਿੱਖਣਾ ਚਾਹੁੰਦੇ ਹੋ ਉਹ ਵੀ ਓਪਸ਼ਨ ਹੈਗੀ ਆ ਆਪਣੇ ਕੋਲ ਹਾਂਜੀ ਅਤੇ ਹਾਂਜੀ ਹਾਂਜੀ ਚਲੋ ਸਰ ਮੈਂ ਤੁਹਾਨੂੰ ਈਮੇਲ ਆਈਡੀ ਆਪਣੀ ਵਟਸਅਪ ਕਰ ਦਿੰਦਾ ਫਿਰ ਆਪਾਂ ਉੱਤੋਂ ਅੱਗੇ ਦੇਖ ਲੈਂਦੇ ਜੀ ਠੀਕ ਹੈ ਟਾਈਮਿੰਗ ਆਪਣੀ ਛੇ ਤੋਂ ਅੱਠ ਸ਼ਾਮ ਨੂੰ ਵੀ ਰੱਖ ਸਕਦੇ ਜੇ ਤੁਸੀਂ ਸਵੇਰੇ ਤੜਕਸਾਰ ਆਉਣਾ ਉਦੋਂ ਵੀ ਛੇ ਤੋਂ ਅੱਠ ਰੱਖ ਸਕਦੇ ਦੋ ਘੰਟੇ ਨਹੀਂ ਤਾਂ ਛੇ ਤੋਂ ਸੱਤ ਵੀ ਠੀਕ ਆ ਕਿਉਂਕਿ ਉਦੋਂ ਆਵਾਜ਼ ਬੰਦਾ ਫਰੈਸ਼ ਹੁੰਦਾ ਉਦੋਂ ਵਧੀਆ ਆਵਾਜ਼ ਸੈੱਟ ਹੋ ਜਾਂਦੀ ਹੈ ਚਲੋ ਬਾਕੀ ਮੈਂ ਤੁਹਾਨੂੰ ਫਿਰ ਬਾਅਦ 'ਚ ਕੋਲ ਕਰਦਾ ਓਕੇ ਠੀਕ ਹੈ ਠੀਕ ਸਤਿ ਸ਼੍ਰੀ ਅਕਾਲ